ਜਿ ਜਿੱਥੇ ਮੈਂ ਰਹਿੰਦਾ ਹਾਂ ਉਹ ਉਹ ਖੇਤਰ ਅਤੇ ਉਸਦੇ ਆਸ ਪਾਸ ਦੇ ਖੇਤਰ ਇੱਕ ਕਾਫੀ ਪ੍ਰਸਿੱਧ ਪੰਜਾਬੀ ਰਾਜ ਵੰਸ਼ ਤੋਂ ਪ੍ਰਭਾਵਿਤ ਹਨ ਜਿਨਾਂ ਦਾ ਨਾਮ ਹੈ ਰੰਜੀ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਪੂਰੇ ਪੰਜਾਬ ਦੇ ਕਾਫੀ ਕਾਫੀ ਵੱਡੀਆਂ ਵੱਡੀਆਂ ਏ ਰਾਜਾਂ ਦੇ ਰਾਜ ਕੀਤਾ ਅਤੇ ਉਹ ਕਾਫੀ ਪ੍ਰਸਿੱਧ ਹਨ ਅ ਉਹਨਾਂ ਨੇ ਆਪਣਾ ਰਾਜ ਮਾਝਾ ਮਾਲਵਾ ਤੋਂ ਲੈ ਕੇ ਦੁਆਬਾ ਪੁਆਧੀ ਤੱਕ ਉਹਨਾਂ ਦਾ ਰਾਜ ਚੱਲਿਆ ਸੀ ਅਤੇ ਸਾਡੇ ਇਲਾਕੇ ਵਿੱਚ ਉਹਨਾਂ ਦਾ ਰਾਜ ਸਤਲੁਜ ਦਰਿਆ ਤੱਕ ਤੱਕ ਸੀ ਜਿੱਥੇ ਉਹਨਾਂ ਦੀ ਕਾਫੀ ਪ੍ਰਸਿੱਧ ਮੀਟਿੰਗ ਵੀ ਹੋਈ ਅੰਗਰੇਜ਼ਾਂ ਨਾਲ ਜੋ ਦਰਿਆ ਦੇ ਕੰਢੇ ਹੋਏ ਸੀ ਜੋ ਜਿੱਥੇ ਕਿ ਉਹਨਾਂ ਦੀ ਯਾਦ ਵਿੱਚ ਅੱਜ ਇੱਕ ਪਾਰਕ ਵੀ ਕਾਫੀ ਪ੍ਰਸਿੱਧ ਅਤੇ ਖੂਬਸੂਰਤ ਬਣੀ ਹੋਈ ਹੈ ਅੱਜ ਉਸ ਪਾਰਕ ਕ ਕਾਫੀ ਲੋਕੀ ਘੁੰਮਣ ਫਿਰਨ ਵੀ ਆਉਂਦੇ ਹਨ ਅਤੇ ਉਹਨਾਂ ਦੀਆਂ ਇਤਿਹਾਸਕ ਨਿਸ਼ਾਨੀਆਂ ਵੀ ਉੱਥੇ ਮਿਲਦੀਆਂ ਹਨ